ਹੈਲੋ ਸਿੰਚਾਈ ਵਿਭਾਗ ਤੋਂ ਬੋਲਦੇ ਹੋ ਮੈਂ ਬੋਲਦੀ ਹਾਂ ਅਜੀਤ ਅਦੀਬਾਰ ਤੋਂ ਜਲੰਧਰ ਤੋਂ ਹਾਂ ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੇ ਪੰਜਾਬ 'ਚ ਦਰਿਆ ਵਗਦੇ ਆ ਇਹ ਕਿਹੜੇ ਕਿੱਧਰ ਕਿੱਧਰ ਦੀ ਹੋ ਕੇ ਵਗਦੇ ਹੈ

ਅੱਛਾ ਅਤੇ ਇਹਦੇ ਵਿੱਚ ਫਿਰ ਜਿਹੜੀ ਇਹ ਮਤਲਬ ਲੋਕਾਂ ਨੂੰ ਫ਼ਸਲਾਂ ਬੀਜਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਵੀ ਕੋਈ ਪਾਣੀ ਵਗੈਰਾ ਦੀ ਠੀਕ ਹੈ ਇਹ ਸੀ ਜਦੋਂ ਮਤਲਬ ਜਿਵੇਂ ਹੁਣ ਦਰਿਆਵਾਂ ਦੇ ਇਲਾਕੇ ਜਿਹੜੇ ਸੁੱਕੇ ਹੁੰਦੇ ਆ ਉਹਦੇ ਵਿੱਚ ਮਤਲਬ ਇਹ ਲੋਕ ਫ਼ਸਲ ਬੀਜਦੇ ਆ ਅਤੇ ਉਹ ਫਿਰ ਮਤਲਬ ਕਈ ਵਾਰੀ ਹੜ੍ਹਾਂ ਦੀ ਮਾਰ 'ਚ ਆ ਜਾਂਦੇ ਆ ਅਤੇ ਉਹਦੇ ਨਾਲ ਫਿਰ ਨੁਕਸਾਨ ਤਾਂ ਬਹੁਤ ਹੁੰਦਾ ਹੋਣਾ ਅਤੇ ਉਹ ਫਿਰ ਮੁਆਵਜ਼ਾ ਫਿਰ ਸਰਕਾਰ ਦਿੰਦੀ ਹੈ

ਅੱਛਾ ਅਤੇ ਇਹ ਫਿਰ ਇਹਦਾ ਪਾਣੀ ਦੀ ਘਾਟ ਵੀ ਹੋ ਰਹੀ ਹੈ ਵੀ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਤੁਸੀਂ ਜਿਹੜਾ ਇਹ ਝੋਨਾ ਹੈ ਉਹ ਨਾ ਬੀਜੋ ਮਤਲਬ ਇਹ ਜਿਹੜੀਆਂ ਸਬਜ਼ੀਆਂ ਵਗੈਰਾ ਦਾਲਾਂ ਵਗੈਰਾ ਇਹ ਬੀਜੋ ਅਤੇ ਮੂੰਗੀ ਬੀਜੋ ਵੀ ਇਹਨਾਂ ਦੀ ਇਹ ਘਾਟ ਹੈ ਅਤੇ ਤੁਸੀਂ ਇਹ ਮਤਲਬ ਕਿ ਨਿਰਾ ਜਿਹੜਾ ਪਾਣੀ ਆਪਾਂ ਬਚਾ ਸਕਦੇ ਹਾਂ ਕਿਉਂਕਿ ਪਾਣੀ ਇਹ ਅੱਗੇ ਅੱਗੇ ਕਹਿੰਦੇ ਪਾਣੀ ਜਿਹੜੇ ਡੂੰਘੀ ਹੋ ਜਾਰੇ ਜਾਂਦੇ ਪਏ ਨੇ

ਹਾਂ ਅੱਛਾ

ਚਾਹੀਦੀ ਹੈ ਸਰਕਾਰ ਜੋ ਕਹਿੰਦੀ ਕਰਨਾ ਚਾਹੀਦਾ ਚੱਲੋ ਠੀਕ ਹੈ ਜੀ ਓਕੇ ਥੈਂਕ ਯੂ